ਇਹ ਗੱਲ ਇੱਕਦਮ ਸਹੀ ਹੈ ਕਿ ਡਾਂਸ ਵਿੱਚ ਦਰਸ਼ਕ ਦਰਸ਼ਕਾਂ ਵਿੱਚ ਭਾਵਨਾ ਪੈਦਾ ਕਰ ਪੈਦਾ ਕਰਨ ਦੀ ਸ਼ਕਤੀ ਹੁੰਦੀ ਹੈ ਡਾਂਸ ਇੱਕ ਇਹ ਰਾਹ ਹੈ ਜਿਹਦੇ ਨਾਲ ਆਪਾਂ ਆਪਣੇ ਮਨ ਦੇ ਵਿਚਾਰ ਆਪਣੇ ਹੱਥਾਂ ਦੇ ਇਸ਼ਾਰਿਆਂ ਨਾਲ ਦੱਸ ਸਕਦੇ ਹਾਂ ਡਾਂਸ ਨਾਲ ਅਸੀਂ ਜੋ ਚੀਜ਼ ਅਸੀਂ ਆਪਣੇ ਮੁੱਖ ਨਾਲ ਵਿਅਕਤ ਨਹੀਂ ਕਰ ਸਕਦੇ ਉਹ ਅਸੀਂ ਆਪਣੇ ਡਾਂਸ ਦੇ ਰਾਹੀਂ ਕਰ ਸਕਦੇ ਹਾਂ ਕਈ ਪ੍ਰਕਾਰ ਦਾ ਡਾਂਸ ਹੁੰਦਾ ਹੈ ਜਿਵੇਂ ਕਿ ਸਾਡਾ ਗਿੱਧਾ ਹੋ ਗਿਆ ਉਹ ਵੀ ਇੱਕ ਡਾਂਸ ਹੈ ਜਿਹੜੇ ਲੋਕ ਗਿੱਧਾ ਦੇਖਦੇ ਹੈ ਉਹਦੇ ਵਿੱਚ ਵੀ ਇਹ ਚੀਜ਼ ਆ ਜਾਂਦੀ ਹੈ ਮੈਂ ਵੀ ਗਿੱਧਾਂ ਕਰਾਂ ਇਹ ਸਾਡੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੈ ਇਸ ਕਰਕੇ ਡਾਂਸ ਲੋਕਾਂ ਵਿੱਚ ਭਾਵਨਾ ਕ੍ਰੀਏਟ ਭਾਵਨਾ ਲਿਆਉਂਦਾ ਹੈ ਜਿੱਦਾਂ ਜਿੱਦਾਂ ਡਾਂਸ ਹੋਵੇਗਾ ਉੱਦਾਂ ਉੱਦਾਂ ਲੋਕਾਂ ਦੇ ਦਿਮਾਗ 'ਚ ਆਏਗਾ ਇਹ ਸਾਡੇ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੈ ਸਾਨੂੰ ਇਸ ਉੱਤੇ ਕੰਮ ਕਰਨਾ ਚਾਹੀਦਾ ਹੈ ਔਰ ਇਹਨੂੰ ਔਰ ਵਧਾਉਣਾ ਚਾਹੀਦਾ ਹੈ